ਮੇਰੀ ਮਨਪਸੰਦ ਕਿਤਾਬ ਲੜੀ ਦੇ ਵਿੱਚ ਇੱਕ ਕਿਤਾਬ ਭਗਵਤ ਗੀਤਾ ਹੈ ਜਿਸ ਨੂੰ ਪੜ੍ਹ ਕੇ ਮੇਰੇ ਦਿਲ ਨੂੰ ਸਕੂਨ ਮਿਲਦਾ ਹੈ ਮੇਰੀ ਸਾਰੀ ਚਿੰਤਾ ਦੂਰ ਹੋ ਜਾਂਦੀ ਹੈ ਇਸ 'ਤੇ ਵੀ ਇਸ ਨੂੰ ਪੜ੍ਹ ਕੇ ਮੇੈਂ ਮੈਨੂੰ ਮੇਰੀ ਮੁਸ਼ਕਿਲਾਂ ਤੋਂ ਲੜਨ ਦੀ ਹਿੰਮਤ ਮਿਲਦੀ ਹੈ ਇਸ ਨੂੰ ਪੜ੍ਹ ਕੇ ਮੇਰੇ ਮਨ ਨੂੰ ਸ਼ਾਂਤੀ ਮਿਲਦੀ ਹੈ ਇਸਨੂੰ ਪੜ੍ਹ ਕੇ ਇੱਕ ਮਨੁੱਖ ਦਾ ਡਿਪਰੈਸ਼ਨ ਵੀ ਦੂਰ ਹੋ ਜਾਂਦਾ ਹੈ ਮੈਂ ਇਸ ਕਿਤਾਬ ਨੂੰ ਤਿੰਨ ਚਾਰ ਵਾਰ ਪੜ੍ਹ ਚੁੱਕੀ ਹਾਂ ਅਤੇ ਇਸ ਨੂੰ ਪੜ੍ਹ ਕੇ ਮੈਂ ਆਪਣੀ ਜ਼ਿੰਦਗੀ ਨੂੰ ਇੱਕ ਸਹੀ ਰਾਹ ਪਾਇਆ ਹੈ